ਮੈਂ ਉੱਤਰੀ ਭਾਰਤ ਵਿੱਚ ਰਹਿੰਦੀ ਹਾਂ ਸਾਡੇ ਇਲਾਕੇ ਵਿੱਚ ਮੱਕੀ ਦੀ ਰੋਟੀ ਅਤੇ ਸਾਗ ਸਾਗ ਨਾਲ ਲੱਸੀ ਅਤੇ ਸਾਗ ਵਿੱਚ ਮੱਖਣੀ ਪਾ ਕੇ ਉਸਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ ਮੈਨੂੰ ਮੈਨੂੰ ਉੱਤਰੀ ਭਾਰਤ ਦਾ ਖਾਣਾ ਬਹੁਤ ਪਸੰਦ ਹੈ ਪਰ ਮੈਨੂੰ ਦੱਖਣੀ ਭਾਰਤ ਦਾ ਵੀ ਖਾਣਾ ਪਸੰਦ ਹੈ ਪਰ ਮੈਨੂੰ ਆਪਣੇ ਇਲਾਕੇ ਦਾ ਖਾਣਾ ਬਹੁਤ ਜ਼ਿਆਦਾ ਪਸੰਦ ਹੈ ਉਹ ਦੱਖਣੀ ਭਾਰਤ ਵਿੱਚ ਜਿਵੇਂ ਕਿ ਇਟਲੀ ਡੋਸਾ ਆਦਿ ਬਣਾ ਆਦਿ ਪਕਵਾਨ ਬਣਾਏ ਜਾਂਦੇ ਹਨ ਮੈਨੂੰ ਉਹ ਵੀ ਪਸੰਦ ਹੈ ਪਰ ਮੈਨੂੰ ਆਪਣੇ ਉੱਤਰੀ ਭਾਰਤ ਦਾ ਖਾਣਾ ਬਹੁਤ ਵਧੀਆ ਲੱਗਦਾ ਹੈ ਅਤੇ ਮੈਂ ਉਸ ਨੂੰ ਬੜੇ ਚਾਅ ਨਾਲ ਖਾਂਦੀ ਹਾਂ ਅਤੇ ਉਸਨੂੰ ਮੈਂ ਬੜੇ ਚਾਅ ਨਾਲ ਖਾਂਦੀ ਹਾਂ ਸਾਡੇ ਉੱਤਰੀ ਭਾਰਤ ਵਿੱਚ ਦਾਲਾਂ ਬਣਾਈਆਂ ਜਾਂਦੀਆਂ ਹਨ ਜਿਵੇਂ ਕਿ ਮੂੰਗੀ ਮਸਰ ਸਾਬਤੇ ਮਸਰ ਭਿੰਡੀ ਦੀ ਸਬਜ਼ੀ ਗੋਭੀ ਦੀ ਸਬਜ਼ੀ ਆਦੀ ਬਣਾਈਆਂ ਜਾਂਦੀਆਂ ਹਨ ਮਨ ਮੈਂ ਉਹਨਾਂ ਨੂੰ ਬੜੇ ਹੀ ਪਸੰਦ ਕਰਦੀ ਹਾਂ ਅਤੇ ਬੜੇ ਹੀ ਚਾਅ ਨਾਲ ਖਾਂਦੀ ਹਾਂ ਮੈਨੂੰ ਇਹੋ ਜਿਹਾ ਖਾਣਾ ਬਹੁਤ ਹੀ ਵਧੀਆ ਲੱਗਦਾ ਹੈ ਜੋ ਸਾਡੇ ਪੇਂਡੂ ਸੱਭਿਆਚਾਰ ਨਾਲ ਸੰਬੰਧਿਤ ਹੁੰਦਾ ਹੈ ਸਾਨੂੰ ਇਹੋ ਜਿਹਾ ਖਾਣਾ ਖਾਣਾ ਚਾਹੀਦਾ ਹੈ ਅਤੇ ਆਪਣੇ ਸਿਹਤ ਨਾਲ ਸਿਹਤ ਨੂੰ ਵਧੀਆ ਰੱਖਣ ਲਈ ਸਾਨੂੰ ਹਰੀਆਂ ਸਬਜ਼ੀਆਂ ਜਿਆਦਾ ਖਾਣੀਆਂ ਚਾਹੀਦੀਆਂ ਹਨ ਜਿਸ ਨਾਲ ਸਾਡੀ ਸਿਹਤ 'ਤੇ ਵੀ ਵਧੀਆ ਅਸਰ ਹੁੰਦਾ ਹੈ ਅਤੇ ਅਸੀਂ ਤੰਦਰੁਸਤ ਰਹਿੰਦੇ ਹਾਂ